ਮੈਂ ਚਿੱਤਰਕਾਰੀ ਦਸਵੀਂ ਜਮਾਤ ਤੋਂ ਸ਼ੁਰੂ ਕੀਤੀ ਮੈਨੂੰ ਚਿੱਤਰਕਾਰੀ ਵਿੱਚ ਬਹੁਤ ਦਿਲਚਸਪੀ ਹੈ ਮੈਂ ਚਿੱਤਰਕਾਰੀ ਵਿੱਚ ਆਪਣੀ ਦਿਲਚਸਪੀ ਆਪਣੀ ਵੱਡੀ ਭੈਣ ਤੋਂ ਲਿਆਈ ਜੋ ਕਿ ਮੇਰੀ ਭੈਣ ਵੀ ਇੱਕ ਚਿੱਤਰਕਾਰ ਹੈ ਉਹ ਦੂਸਰੇ ਬੱਚਿਆ ਨੂੰ ਚਿੱਤਰਕਾਰੀ ਕਰਨਾ ਵੀ ਸਿਖਾਉਂਦੇ ਹਨ ਮੈਂ ਪਹਿਲੀ ਵਾਰੀ ਚਿੱਤਰਕਾਰੀ ਆਪਣੀ ਭੈਣ ਕੋਲ ਸਿੱਖੀ ਅਤੇ ਉਹਨਾਂ ਨੇ ਮੈਨੂੰ ਹਰ ਚੀਜ਼ ਸਿਖਾਈ ਕੀ ਕਯਾ ਚੀਜ਼ ਕਿੰਨੀ ਕੁ ਸ਼ੇਡ ਵਗੈਰਾ ਜੋ ਵੀ ਉਸਦੇ ਵਿੱਚ ਵਰਤੋਂ ਹੁੰਦੀਆਂ ਨੇ ਉਹ ਸਭ ਮੈਂ ਆਪਣੀ ਭੈਣ ਦੇ ਕੋਲ ਸਿੱਖਿਆ ਇਹਨਾਂ ਮੇਰੀ ਭੈਣ ਤੋਂ ਇਲਾਵਾ ਇੱਕ ਕਲਾਕਾਰ ਰਾਜਾ ਰਵੀ ਵਰਮਾ ਜੀ ਹਨ ਜਿਨ੍ਹਾਂ ਤੋਂ ਮੈਂ ਚਿੱਤਰਕਾਰੀ ਦੀ ਤਰਫ਼ ਪ੍ਰੋਤਸਾਹਿਤ ਹੋਈ